ਤੁਸੀਂ ਕਮਲਪ੍ਰੀਤ ਬੋਲਦੇ ਹੋ ਮੈਂ ਨਾ ਆਪਣੀ ਫਰੈਂਡ ਤੋਂ ਤੁਹਾਡਾ ਕੰਟੈਕਟ ਨੰਬਰ ਲਿਆ ਸੀ ਮੈਂ ਨਾ ਫੂ ਮੈਂ ਇੱਕ ਫੂਡ ਬਲੋਗਰ ਹੈ ਮੈਂ ਮੁੰਬਈ ਦੇ ਵਿੱਚ ਫੂਡ ਬਲੋਗਿੰਗ ਕਰਦੀ ਹਾਂ ਅਤੇ ਹੁਣ ਰੀਸੈਂਟਲੀ ਮੈਂ ਪੰਜਾਬ ਆਈ ਹੋਈ ਸੀ ਅਤੇ ਇੱਕ ਮੇਰੀ ਫਰੈਂਡ ਹੈ ਜੋ ਪੰਜਾਬ ਦੇ ਵਿੱਚ ਰਹਿੰਦੀ ਹੈ ਮੈਂ ਉਹਨਾਂ ਕੋਲੋਂ ਤੁਹਾਡਾ ਨੰਬਰ ਲਿਆ ਸੀ ਉਹ ਤੁਹਾਡੇ ਨੋਨ ਨੇ ਅਤੇ ਮੈਂ ਉਹ ਮੈਨੂੰ ਦੱਸਦੇ ਸੀ ਕਿ ਤੁਹਾਨੂੰ ਮੋਹਾਲੀ ਦੀ ਬੇਕਰੀਜ਼ ਦੇ ਬਾਰੇ ਅਤੇ ਰੈਸਟੋਰੈਂਟ ਦੇ ਬਾਰੇ ਬਹੁਤ ਨੌਲਿਜ਼ ਹੈ ਤੁਸੀਂ ਤੁਸੀਂ ਮੈਨੂੰ ਬਲੋਗਿੰਗ ਦੇ ਵਿੱਚ ਹੈਲਪ ਕਰ ਦੋਂਗੇ ਮੈਨੂੰ ਮੈਂ ਤੁਹਾਡੇ ਤੋਂ ਪੁੱਛਣਾ ਸੀ ਕਿ ਮੋਹਾਲੀ ਦੇ ਵਿੱਚ ਕਿਹੜੀ ਕਿਹੜੀ ਬੇਕਰੀਜ਼ ਹੈ ਜੋ ਬਹੁਤ ਜ਼ਿਆਦਾ ਅੱਛੀਆ ਆ ਜ਼ਾਂ ਫੇਮਸ ਆ ਹਾਂਜੀ ਤੁ

ਹਾਂਜੀ ਔਰ ਤੁਸੀਂ ਮੇਰੀ ਹੈਲਪ ਕਰ ਦੋਂਗੇ ਤੁਸੀਂ ਮੈਨੂੰ ਐਵੇਂ ਦੱਸ ਸਕਦੇ ਹੋ ਕਿ ਉਹਨਾਂ ਬੇਕਰੀਜ਼ ਦੀ ਫੇਮਸ ਜੋ ਕਹਿ ਲਓ ਆਈਟਮ ਆ ਉਹ ਕੀ ਆ ਓਕੇ ਚੱਲੋ ਮੈਂ ਨਾ ਇੱਕ ਵਾਰੀ ਜਦੋਂ ਮਤਲਬ ਮੈਂ ਕੱਲ੍ਹ ਆ ਰਹੀ ਹੈ ਮੋਹਾਲੀ ਦੇ ਵਿੱਚ ਅਤੇ ਮੈਂ ਆਪਣੀ ਜੋ ਵਲੋਗਿੰਗ ਕਰਨੀ ਆ ਫੂ ਬੇਕਰਸ 'ਤੇ ਜਾ ਕੇ ਅਤੇ ਤੁਸੀਂ ਮੈਨੂੰ ਇੱਕ ਵਾਰੀ ਮਿਲ ਲੋਂਗੇ ਅਤੇ ਮੇਰੀ ਹੈਲਪ ਕਰ ਦੋਂਗੇ ਓਕੇ ਥੈਂਕ ਯੂ